ਮੈਂ ਅੱਜ ਤੱਕ ਕਦੀ ਵੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਜਾਂ ਆਪਣੀ ਫੈਮਲੀ ਦੀਆਂ ਤਸਵੀਰਾਂ ਪੋਸਟ ਨਹੀਂ ਕੀਤੀਆਂ ਮੇਰਾ ਸ਼ੁਰੂ ਤੋਂ ਹੀ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕਰਾਉਣ ਵਿੱਚ ਕੋਈ ਇੰਟਰਸਟ ਨਹੀਂ ਰਿਹਾ ਕੋਈ ਰੁਚੀ ਨਹੀਂ ਰਹੀ ਮੈਂ ਆਪਣੇ ਕੈਮਰੇ ਨਾਲ ਖਿੱਚੀਆਂ ਹੋਈਆਂ ਫੋਟੋਆਂ ਖੁਦ ਹੀ ਦੇਖਦਾ ਹਾਂ ਐਡਿਟ ਕਰਦਾ ਹਾਂ ਅਤੇ ਲੋੜ ਅਨੁਸਾਰ ਉਹਨਾਂ ਦੀ ਵਰਤੋਂ ਕਰਦਾ ਹਾਂ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟ ਤਸਵੀਰਾਂ ਪੋਸਟ ਕਰਨਾ ਮੈਨੂੰ ਨਾ ਕਦੇ ਪਸੰਦ ਸੀ ਅਤੇ ਨਾ ਹੀ ਲੱਗਦਾ ਹੈ ਕਿ ਭਵਿੱਖ ਵਿੱਚ ਮੈਂ ਅਜਿਹਾ ਕਰਾਂਗਾ ਮੈਂ ਸੋਸ਼ਲ ਮੀਡੀਆ ਤੋਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੱਕ ਆਪਣੀਆਂ ਤਸਵੀਰਾਂ ਨਹੀਂ ਖਿਚਾਉਣੀਆਂ ਚਾਹੁੰਦਾ